ਮੇਰਾ ਮਨਪਸੰਦ ਭੋਜਨ ਅਤੇ ਸਬਜ਼ੀ ਅ ਸ਼ਾਹੀ ਪਨੀਰ ਮਟਰ ਪਨੀਰ ਅਤੇ ਦਹੀਂ ਭੱਲੇ ਨਿਊਡਲਸ ਟਿੱਕੀ ਬਰਗਰ ਪੀਜਾ ਅਤੇ ਮੈਂ ਆਪਣੇ ਘਰ ਆਪਣੇ ਬੱਚਿਆਂ ਦੇ ਨਾਲ ਖਾਣਾ ਪਸੰਦ ਕਰਦੀ ਹਾਂ